ਤਾਰਿਆਂ ਅਤੇ ਬ੍ਰਹਿਮੰਡ 'ਤੇ ਜੇ ਆਪਾਂ ਅਧਿਐਨ ਕਰੀਏ ਤਾਂ ਆਪਾਂ ਬਹੁਤ ਜਿਹੜੀ ਨੌਲੇਜ ਆਪਾਂ ਗੇਨ ਕਰਦੇ ਹੈਗੇ ਹਾਂ ਕਿਵੇਂ ਆਪਣੀ ਧਰਤੀ ਜਿਹੜੀ ਆ ਐਗਸਜਿਸਟ ਕਰਦੀ ਹੈਗੀ ਆ ਉਹਦੇ ਵਿੱਚ ਕਿਵੇਂ ਗ੍ਰੈਵਿਟੀ ਆਈ ਕਿਵੇਂ ਆਪਾਂ ਮੂਨ 'ਤੇ ਜਾ ਸਕਦੇ ਹਾਂ ਕਿ ਆਪਾਂ ਬ੍ਰਹਿਮੰਡ ਦੇ ਆਪਾਂ ਜੇ ਨੋਲੇਜ ਨਾ ਰੱਖਾਂਗੇ ਤਾਂ ਆਪਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਆਪਾਂ ਮੂਨ 'ਤੇ ਆਪਾਂ ਕਿਵੇਂ ਜਾਵਾਂਗੇ ਜਾਂ ਮੈਂ ਕਿਸੇ ਹੋਰ ਪਲੈਨਟ 'ਤੇ ਆਪਾਂ ਆਪਾਂ ਜਿਹੜੀਆਂ ਕਿ ਆਪਾਂ ਰਹਿ ਸਕਦੇ ਹਾਂ ਕਿ ਨਹੀਂ ਰਹਿ ਸਕਦੇ ਹੈਗੇ ਆਪਾਂ ਨੂੰ ਇਹ ਕਿਵੇਂ ਚੀਜ਼ ਦਾ ਪਤਾ ਹੋਵੇਗਾ ਅਗਰ ਆਪਾਂ ਨੌਲਜ ਰੱਖਾਂਗੇ ਤਾਂ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਆਵੇਗੀ